ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਾਂ ਠੀਕ ਹੈ ਤੁਸੀਂ ਸੁਣਾਓ ਮੈਂ ਤੁਹਾਨੂੰ ਵੇਖਿਆ ਗੁਰਦੁਆਰੇ ਮੈਂ ਕਿਹਾ ਇੱਦਾਂ ਲੱਗਦਾ ਕਲੋਨੀ 'ਚ ਨਵੇਂ ਆਏ ਭੈਣ ਜੀ ਦੇਖਦੀ ਮੈਂ ਤੁਹਾਨੂੰ ਰੋਜ਼ ਹੀ ਵੇਖਦੀ ਹਾਂ ਅਤੇ ਮੈਨੂੰ ਬੜਾ ਚੰਗਾ ਲੱਗਦਾ ਮੈਂ ਪੁੱਛਣ ਪੁੱਛਣ ਹੀ ਜਾ ਰਿਹਾ ਸੀ ਮੈਂ ਕਿਹਾ ਚੱਲ ਅੱਜ ਪੁੱਛਦੇ ਹਾਂ ਭੈਣ ਜੀ ਨੂੰ ਅਤੇ ਬੜੇ ਵਧੀਆ ਹੋਰ ਕਿਸ ਤਰ੍ਹਾਂ ਲੱਗਾ ਸਾਡਾ ਫਿਰ ਇੱਧਰ ਤੁਹਾਨੂੰ ਠੀਕ ਹੈ ਇਹ ਤਾਂ ਹੈ ਹਾਂਜੀ ਚਲੋ ਕੋਈ ਨਹੀਂ ਉਹ ਤਾਂ ਹੋ ਹੀ ਜਾਂਦਾ ਭੈਣ ਜੀ ਫਿਰ ਜਦੋਂ ਹੋ ਜਾਵੋਗੇ ਰਹਿਣ ਤਾਂ ਫਿਰ ਠੀਕ ਹੀ ਲੱਗਣ ਲੱਗ ਪੈਣਾ ਹੈ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਸ਼ਾਮੀ 'ਤੇ ਆਇਓ ਕਿਤੇ ਮਿਲਿਓ ਪਾਰਕ ਪੂਰਕ 'ਚ ਮਿਲਾਂਗੇ ਆਇਓ ਹਾਂ ਹਾਂ ਆਇਓ ਹਾਂ ਮਿਲ ਪਾ ਉੱਥੇ ਕਰਿਓ ਦੱਸਾਂਗੇ ਗੱਲਬਾਤ ਹਾਂ ਹੋਰ ਹਾਂ ਹਾਂ ਠੀਕ ਹੈ ਜੀ ਚੰਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ